ਜਦੋਂ ਕਿ ਮੇਰੇ ਕੋਲ ਨਿੱਜੀ ਅਨੁਭਵ ਨਹੀਂ ਹਨ ਬਹੁਤ ਸਾਰੇ ਵਿਅਕਤੀਆਂ ਨੇ ਕਾਰਜਾਂ ਅਤੇ ਪ੍ਰੋਜੈਕਟਾਂ ਨੂੰ ਕੁਸ਼ਲਤਾ ਨਾਲ ਆਊਟਸੋਰਸ ਕਰਨ ਲਈ ਟਾਸਕ ਰੈਬਿਟ ਅਤੇ ਫੀਵਰ ਵਰਗੇ ਵਰਚੁਅਲ ਨਿੱਜੀ ਸਹਾਇਕ ਵੱਲ ਮੁੜਿਆ ਹੈ ਇਹ ਪਲੇਟਫਾਰਮ ਟਾਸਕ ਰੈਬਿਟ ਅਤੇ ਘਰ ਦੀ ਸਫਾਈ ਅਤੇ ਫਰਨੀਚਰ ਅਸੈਂਬਲੀ ਤੋਂ ਲੈ ਕੇ ਫੀਵਰ ਅਤੇ ਗ੍ਰਾਫਿਕ ਡਿਜ਼ਾਇਨ ਰਾਈਟਿੰਗ ਅਤੇ ਪ੍ਰੋਗਰਾਮਿੰਗ ਤੱਕ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਤੱਕ ਪਹੁੰਚ ਪ੍ਰਦਾਨ ਕਰਦੇ ਹਨ ਉਪਭੋਗਤਾ ਅਕਸਰ ਇਹਨਾਂ ਸੇਵਾਵਾਂ ਦੀ ਪੇਸ਼ਕਸ਼ ਦੀ ਸਹੂਲਤ ਅਤੇ ਲਚਕਤਾ ਦੀ ਪ੍ਰਸੰਸਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਵਧੇਰੇ ਦਬਾਅ ਵਾਲੀਆਂ ਜ਼ਿੰਮੇਵਾਰੀਆਂ ਜਾਂ ਪ੍ਰੋਜੈਕਟਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ ਲਈ ਉਹਨਾਂ ਦੀ ਵਿਸ਼ੇਸ਼ ਮੁਹਾਰਤ ਦੀ ਲੋੜ ਹੁੰਦੀ ਹੈ ਪ੍ਰਕਿਰਿਆ ਵਿੱਚ ਆਮ ਤੌਰ 'ਤੇ ਪ੍ਰੋਫਾਈਲਾਂ ਦੁਆਰਾ ਬਰਾਊਜ਼ ਕਰਨਾ ਸਮੀਖਿਆਵਾਂ ਪੜ੍ਹਨਾ ਅਤੇ ਇੱਕ ਫ੍ਰੀਲੈਨਸਰ ਨੂੰ ਉਹਨਾਂ ਦੇ ਹੁਨਰ ਅਤੇ ਦਰਾਂ ਦੇ ਅਧਾਰ 'ਤੇ ਚੁਣਨਾ ਸ਼ਾਮਿਲ ਹੁੰਦਾ ਹੈ ਜੋ ਮਹੱਤਵਪੂਰਨ ਤੌਰ 'ਤੇ ਵੱਖ ਵੱਖ ਹੋ ਸਕਦੇ ਹਨ ਇਹ ਪਹੁੰਚ ਨਾ ਸਿਰਫ ਸਮੇਂ ਦੀ ਬੱਚਤ ਕਰਦੀ ਹੈ ਬਲਕਿ ਉਪਭੋਗਤਾਵਾਂ ਨੂੰ ਵਿਸ਼ੇਸ਼ ਸਹਾਇਤਾ ਲੱਭਣ ਦੇ ਯੋਗ ਵੀ ਬਣਾਉਂਦੀ ਹੈ ਜੋ ਉਹਨਾਂ ਦੇ ਨਜ਼ਦੀਕੀ ਖੇਤਰ ਵਿੱਚ ਆਸਾਨੀ ਨਾਲ ਉਪਲਬਧ ਨਹੀਂ ਹੋ ਸਕਦੀ ਹੈ ਇਸ ਤੋਂ ਇਲਾਵਾ ਇਹ ਪਲੇਟਫਾਰਮ ਅਕਸਰ ਸੁਰੱਖਿਅਤ ਭੁਗਤਾਨ ਵਿਧੀਆਂ ਅਤੇ ਵਿਵਾਦ ਨਿਪਟਾਰਾ ਪ੍ਰਦਾਨ ਕਰਦੇ ਹਨ ਭਾਰਤੀ ਪ੍ਰਕਿਰਿਆ ਵਿੱਚ ਸੁਰੱਖਿਆ ਅਤੇ ਵਿਸ਼ਵਾਸ ਦੀ ਇੱਕ ਪਰਤ ਜੋੜਦੇ ਹਨ ਬਹੁਤ ਸਾਰੇ ਉਪਭੋਗਤਾ ਕੁਸ਼ਲ ਸੰਚਾਰ ਅਤੇ ਉੱਚ ਗੁਣਵੱਤਾ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਸਕਾਰਾਤਮਕ ਤਜਰਬਿਆਂ ਦੀ ਰਿਪੋਰਟ ਕਰਦੇ ਹਨ ਜਦੋਂ ਕਿ ਦੂਸਰੇ ਫ੍ਰੀਲੈਨਸਰਾਂ ਨਾਲ ਸਿੱਧੇ ਤੌਰ 'ਤੇ ਨਿਯਮਾਂ ਅਤੇ ਕੀਮਤਾਂ 'ਤੇ ਗੱਲਬਾਤ ਕਰਨ ਦੀ ਯੋਗਤਾ ਦੀ ਸ਼ਲਾਘਾ ਕਰਦੇ ਹਨ ਸਮੁੱਚੇ ਤੌਰ 'ਤੇ ਵਰਚੁਅਲ ਨਿੱਜੀ ਸਹਾਇਕਾਂ ਦੀ ਵਰਤੋਂ ਕਰਨਾ ਬਹੁਤ ਸਾਰੇ ਲੋਕਾਂ ਲਈ ਆਪਣੇ ਕੰਮਾਂ ਦੇ ਬੋਝ ਨੂੰ ਸੁਚਾਰੂ ਬਣਾਉਣ ਨਿੱਜੀ ਪ੍ਰੋਜੈਕਟਾਂ ਨਾਲ ਨਜਿੱਠਣਾ ਜਾਂ ਰਵਾਇਤੀ ਭਰਤੀ ਪ੍ਰਕਿਰਿਆਵਾਂ ਦੀ ਪਰੇਸ਼ਾਨੀ ਤੋਂ ਬਿਨਾਂ ਪੇਸ਼ੇਵਰ ਸੇਵਾਵਾਂ ਤੱਕ ਪਹੁੰਚ ਕਰਨ ਲਈ ਇੱਕ ਵਿਵਹਾਰਿਕ ਹੱਲ ਬਣ ਗਿਆ ਹੈ